ਪੰਜਾਬ ਵਿੱਚ ਬਹੁਤ ਥੋੜ੍ਹੇ ਕਮੇਡੀਅਨ ਕਲੱਬ ਹਨ ਜਿਸ ਵਿੱਚ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਕਿ ਮੈਂ ਪਟਿਆਲੇ ਦੀ ਵਸਨੀਕ ਹਾਂ ਜਿੱਥੇ ਪਟਿਆਲੇ ਵਿੱਚ ਬਹੁਤ ਸਾਰੇ ਮੇਲੇ ਲੱਗ ਜਿਸ ਵਿੱਚ ਇੱਕ ਮੇਲਾ ਸ਼ੀਸ਼ ਮਹਿਲ ਵਿੱਚ ਲੱਗਦਾ ਹੈ ਜਿਸ ਵਿੱਚ ਬਹੁਤ ਸਾਰੇ ਕਲਾਕਾਰ ਅਤੇ ਕਮੇਡੀਅਨ ਹਾਸੀ ਮਜ਼ਾਕ ਵਾਲੇ ਸਾਰੇ ਆਉਂਦੇ ਹਨ ਕਿ ਲੋਕਾਂ ਦਾ ਮਨੋਰੰਜਨ ਕਰਦੇ ਹਨ ਜਿਨ੍ਹਾਂ ਵਿੱਚ ਇੱਕ ਕਮੇਡੀਅਨ ਕਪਿਲ ਸ਼ਰਮਾ ਸ਼ੋ ਵਾਲੇ ਵੀ ਇੱਥੇ ਆਏ ਜਿਨ੍ਹਾਂ ਨੇ ਲੋਕਾਂ ਨੂੰ ਹਾਸੀ ਮਜ਼ਾਕ ਨਾ ਲੋਕਾਂ ਨੂੰ ਲੁੱਟ ਵੁੱਟ ਕੀਤਾ ਅਤੇ ਲੋਕਾਂ ਨੂੰ ਨਸ਼ਾ ਮੁਕਤ ਰਹਿਣ ਦੀ ਪ੍ਰੇਰਨਾ ਦਿੱਤੀ ਅਤੇ ਮੈਂ ਇਹਨਾਂ ਦੀ ਬਹੁਤ ਪ੍ਰਸੰਸਾ ਕਰਦੀ ਹਾਂ ਅਤੇ ਮੈਂ ਘਰ ਆ ਕੇ ਵੀ ਸਾਰਿਆਂ ਨੂੰ ਹਾਸੀ ਮਜ਼ਾਕ ਬਾਰੇ ਗੱਲਾਂ ਕੀਤੀਆਂ ਕਿ ਲੋਕ ਆਪਣੇ ਦਿਮਾਗ ਵਿੱਚੋਂ ਇਹ ਗੱਲਾਂ ਕੱਢ ਕੇ ਹਾਸੀ ਮਜ਼ਾਕ ਵੱਲ ਜਾਓ ਅਤੇ ਖੁਸ਼ ਰਹੋ ਅਤੇ ਤੰਦਰੁਸਤ ਰਹੋ ਆਪਣੀ ਸਿਹਤ ਦਾ ਧਿਆਨ ਰੱਖੋ